ਮੇਰੇ ਖਿਆਲ ਦੇ ਵਿੱਚ ਪੰਜਾਬੀ ਭਾਸ਼ਾ ਆਪਣੇ ਆਪ ਦੇ ਵਿੱਚ ਇੱਕ ਪਹਿਚਾਣ ਅਤੇ ਆਪਣੀ ਭੂਮਿਕਾ ਨਿਭਾਉਂਦੀ ਹੈ ਮੈਂ ਪੰਜਾਬ ਦੀ ਵਸਨੀਕ ਹਾਂ ਔਰ ਮੈਂ ਮਾਣ ਕਰਦੀ ਹਾਂ ਕਿ ਮੈਂ ਪੰਜਾਬੀ ਹਾਂ ਕਿਉਂਕਿ ਪੰਜਾਬੀਆਂ ਦਾ ਇੱਕ ਰੁਤਬਾ ਔਰ ਇੱਕ ਜੋ ਉਹਨਾਂ ਦੀ ਪਹਿਚਾਣ ਹੈ ਉਹ ਉਹਨਾਂ ਦੇ ਨਾਮ ਤੋਂ ਹੀ ਝਲਕਦੀ ਹੈ ਇਹਨਾਂ ਦੇ ਵਿੱਚ ਬਹਾਦਰਤਾ ਇਹਨਾਂ ਦੇ ਵਿੱਚ ਆਪਣੀ ਕਰਮ ਦੀ ਕਰਨ ਦੀ ਜੋ ਉੱਦਤਾ ਹੁੰਦੀ ਹੈ ਜੋ ਉਹਨਾਂ ਦੇ ਵਿੱਚ ਨਿਸ਼ਟਾ ਹੁੰਦੀ ਹੈ ਇਹ ਸਭ ਤੋਂ ਵੱਖਰੀ ਹੈ ਪੰਜਾਬੀਆਂ ਦਾ ਖਾਣਾ ਪੀਣਾ ਰਹਿਣਾ ਮੌਜ ਮਸਤੀ ਸਾਰੇ ਵਿਸ਼ਵ ਦੇ ਵਿੱਚ ਇੱਕ ਨੰਬਰ 'ਤੇ ਹੈ ਪੰਜਾਬੀ ਆਪਣੇ ਆਪ ਦੇ ਵਿੱਚ ਹੀ ਆਪਣੀ ਇੱਕ ਅਲੱਗ ਪਹਿਚਾਣ ਬਣਾਉਂਦੇ ਹਨ ਔਰ ਮੇਂ ਆਪਣੇ ਮੈਂ ਆਪਣੇ ਆਪ ਨੂੰ ਪੰਜਾਬੀ ਹੋਣ 'ਤੇ ਮਾਣ ਕਰਦੀ ਹਾਂ